ਜਿਵੇਂ ਕਿ ਤੁਸੀਂ ਮੈਨੂੰ ਪੁੱਛਿਆ ਹੈ ਪੰਜ ਸਟੇਟਾਂ ਦੇ ਨਾਮ ਜੋ ਕਿ ਇੰਡੀਆ ਵਿੱਚ ਹਨ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਹਿਮਾਚਲ